ਹੈਲੋ ਹਾਂਜੀ ਫਲਿੱਪਕਾਰਟ ਤੋਂ ਗੱਲ ਕਰ ਰਹੇ ਹੋ ਜੀ ਮੈ ਫਲਿੱਪਕਾਰਟ ਤੋਂ ਜੀ ਇੱਕ ਸਮਾਨ ਆਪਣੀਆਂ ਕੜਾਹੀਆਂ ਵਗੈਰਾ ਕਿਚਨ ਦਾ ਸਮਾਨ ਮੰਗਵਾਇਆ ਸੀ ਉਹ ਸਮਾਨ ਜਿਹੜਾ ਕਿ ਸਾਰਾ ਹੀ ਪੈਕਿੰਗ ਹੀ ਗਲਤ ਕੀਤੀ ਹੋਈ ਸੀ ਪੈਕਿੰਗ ਸਹੀ ਨਹੀਂ ਸੀ ਪੈਕਿੰਗ ਖੋਲ੍ਹਦਿਆ ਸਾਰ ਹੀ ਮੈਂ ਜਬ ਵੀ ਸਮਾਨ ਚੈੱਕ ਕੀਤਾ ਤਾਂ ਸਮਾਨ ਵਿੱਚ ਸਾਰਾ ਸ ਸਾਰਾ ਸਮਾਨ ਖ਼ਰਾਬ ਨਿਕਲ ਗਿਆ ਸਾਰਾ ਸਮਾਨ ਖ਼ਰਾਬ ਸੀ ਤੋ ਮੇਰੇ ਕੋਈ ਨਾ ਸਮਾਨ ਵਿੱਚ ਕੋਈ ਸਕਰਬਰ ਹੈ ਕੁਛ ਵੀ ਨਹੀਂ ਹੈ ਅਸੀਂ ਇੱਕ ਉਮੀਦ ਕਰਕੇ ਤੁਹਾਡੀ ਜੋ ਐਪ ਆਗੀ ਇਹਨਾਂ ਤੋਂ ਮੈਂ ਸਮਾਨ ਤੁਹਾਡੇ ਤੋਂ ਮੰਗਵਾਇਆ ਸੀ ਇਸੇ ਕਰਕੇ ਸਾਰਾ ਹੀ ਸਮਾਨ ਖ਼ਰਾਬ ਆ ਮੇਰੇ ਹਸਬੈਂਡ ਵਗੈਰਾ ਸਭ ਮੇਰੇ ਸੇ ਗੁੱਸਾ ਹੋ ਰ ਮੇਰੇ ਤੋਂ ਗੁੱਸੇ ਹੋ ਰਹੇ ਆ ਤੋ ਇਸ ਇਹ ਸਮਾਨ ਦਾ ਮੈਂ ਕੀ ਕਰਨਾ ਜੋ ਖ਼ਰਾਬ ਆ ਮੈਂ ਮੈਂ ਤੁਹਾ ਮੇਰੇ ਸਾਰੇ ਵਾਪਿਸ ਕਰੋ ਪੈਸੇ ਔਰ ਆਪਣਾ ਸਮਾਨ ਖੁਦ ਲੇ ਕੇ ਜਾਓ ਔਰ ਮੈਂ ਮੈਂ ਨਹੀਂ ਇਹ ਸਮਾਨ ਤੁਹਾਡਾ ਰੱਖਣਾ ਔਰ ਮੈਂ ਇਸ ਪੈਸਿਆਂ ਇਹ ਸਮਾਨ ਦੇ ਬਦਲੇ ਨਾਲੇ ਮੇਰੇ ਪੈਸੇ ਦੋ ਨਾਲੇ ਮੈਨੂੰ ਦੁਬਾਰਾ ਸਮਾਨ ਸਾਰਾ ਜੋ ਵੀ ਮੈਨੂੰ ਮੈਂ ਔਡਰ ਕੀਤਾ ਸੀ ਸਾਰਾ ਸਮਾਨ ਮੇਰਾ ਤੁਹਾਡੇ ਵੱਲੋਂ ਫਰੀ ਦਿਓ ਇਹ ਇਹ ਥੋੜ੍ਹੀ ਨਾ ਹੁੰਦਾ ਵੀ ਸਾਰਾ ਹੀ ਸਮਾਨ ਤੁਹਾਡੇ ਸਾਰੇ ਮੈਂ ਜੋ ਕੜਾਹੀਆਂ ਔਰ ਕਿਚਨ ਦਾ ਜੋ ਸਮਾਨ ਮੰਗਵਾਇਆ ਨਾ ਸਾਰੇ ਸਮਾਨ 'ਤੇ ਸਕਰੈਚ ਪਏ ਹੋਏ ਆ ਵੱਜੀਆਂ ਹੋਈਆਂ ਆ ਅਤੇ ਮੈਂ ਇਹ ਮੈਂ ਮੇਰੇ ਘਰ ਗੈਸਟ ਆਉਣੇ ਸੀ ਅਤੇ ਮੈਂ ਸੋਚਿਆ ਵੀ ਤੁਹਾਡੇ ਤੋਂ ਫਲਿੱਪਕਾਰਟ ਤੋਂ ਸਮਾਨ ਮੰਗਾਵਾਂ ਤੁਹਾਡਾ ਨਾਂ ਸੁਣਿਆ ਸੀ ਇਸ ਕਰਕੇ ਤੁਹਾਡਾ ਕੋਈ ਵੀ ਸਮਾਨ ਵਧੀਆ ਨਹੀਂ ਨਿਕਲਿਆ ਹੁਣ ਮੇਰੇ ਤੋਂ ਗੈਸਟ ਜਿਹੜੇ ਵੀ ਗੈਸਟ ਆਏ ਆ ਸਾਰੇ ਤੋ ਨਾਰਾਜ਼ ਆ ਨਾ ਅਤੇ ਇਸ ਲਈ ਮੈਂ ਨਹੀਂ ਤੁਹਾਡਾ ਸਮਾਨ ਨਹੀਂ ਰੱਖਣਾ ਚਾਹੁੰਦੀ ਇਸ ਕਰਕੇ ਮੇਰਾ ਸਮਾਨ ਸਾਰਾ ਖੁ ਵਾਪਿਸ ਲੇ ਕੇ ਜਾਓ ਡਲੀਵਰ ਕਰ ਡਲੀਵਰੀ ਤੁਹਾਡੀ ਮੈਂ ਨਹੀਂ ਕੁਛ ਵੀ ਤੁਹਾਡੀ ਫ੍ਰੀ ਡਲੀਵਰੀ ਸੀ ਜਾਂ ਕੁਛ ਵੀ ਸੀ ਮੈਂ ਨਹੀਂ ਰੱਖੂਗੀ ਤੁਹਾਡਾ ਸਮਾਨ ਤੁਹਾਡਾ ਸਮਾਨ ਸਾਰਾ ਹੀ ਗਲ ਖ਼ਰਾਬ ਆਇਆ ਖ਼ਰਾਬ ਸਾਰਾ ਹੀ ਸਮਾਨ ਖ਼ਰਾਬ ਆ ਕੋਈ ਚਮਚ ਕੋਈ ਕੜਾਹੀ ਕੋਈ ਕੜਛੀ ਕੁਛ ਵੀ ਨਹੀਂ ਸਹੀ ਨਿਕਲਿਆ ਕੁਛ ਵੀ ਨਹੀਂ ਸਹੀ ਨਿਕਲਿਆ ਸਾਰਾ ਖਰਾਬ ਸਾ ਮੇਰੇ ਜਲਦ ਤੋਂ ਜਲਦ ਸਾਰੇ ਹੀ ਪੈ ਮੇਰੇ ਪੈਸੇ ਵਾਪਿਸ ਕਰੋ ਬਸ ਮੈਂ ਨਹੀਂ ਰੱਖਣਾ ਤੁਹਾਡਾ ਸਮਾਨ